ਪੰਜਾਬ ਦਾ ਕਲਾ ਸ਼ੇਤਰ ਵਿੱਚ ਬਹੁਤ ਵੱਡਾ ਯੋਗਦਾਨ ਨੇ ਅਤੇ ਆਪਾਂ ਦੇਖਦੇ ਹਾਂ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮੌਲਾਂ ਦੇ ਵਿੱਚ ਆਪਾਂ ਹੱਥ ਦੀਆਂ ਬਣੀਆ ਹੋਈਆਂ ਚੀਜ਼ਾਂ ਨੂੰ ਲਿਜਾ ਕੇ ਕਿੱਦਾਂ ਸੇਲ ਕਰਦੇ ਹਾਂ ਅਤੇ ਆਪਾਂ ਦੇਖਦੇ ਹਾਂ ਵੱਡੇ ਵੱਡੇ ਮੌਲਾਂ ਦੇ ਵਿੱਚ ਫੈਕਟਰੀਆਂ ਤੋਂ ਤਿਆਰ ਕੀਤੇ ਗਏ ਸਮਾਨ ਦੀ ਆਪਾਂ ਕਿੱਦਾਂ ਵਰਤੋਂ ਕਰਨੀ ਹੈ ਉਸ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਪੰਜਾਬ ਬੜਾ ਹੀ ਹਰਾ ਭਰਾ ਹਰਿਆਲੀ ਵਾਲਾ ਸ਼ਹਿਰ ਹੈ ਅਤੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਵੱਡੇ ਵੱਡੇ ਯੋਧੇ ਹੋਏ ਨੇ ਅਤੇ ਗੁਰੂਆਂ ਦੀ ਇਹ ਧਰਤੀ ਨੇ ਮੁਕਤਸਰ ਸ਼ਹਿਰ ਦੇ ਵਿੱਚ ਦੇਖਦੇ ਹਾਂ ਜਦ ਮਾਘੀ ਮੇਲਾ ਲੱਗਦਾ ਨੇ ਤਾਂ ਲੋਕੀ ਦੂਰੋਂ ਦੂਰੋਂ ਚੱਲ ਕੇ ਆਪਣੇ ਸਮਾਨ ਨੂੰ ਲੈ ਕੇ ਆਉਂਦੇ ਹਾਂ ਅਤੇ ਨਾਲੇ ਇਸ਼ਤਿਹਾਰ ਛਪਾਉਂਦੇ ਹਾਂ ਅਤੇ ਆਪਣੇ ਸਮਾਨ ਦੀ ਕਿਸ ਤਰ੍ਹਾਂ ਵਰਤੋਂ ਕੀਤੀ ਜਾਵੇ ਦੀ ਜਾਣਕਾਰੀ ਦਿੰਦੇ ਹਾਂ ਜਿੱਦਾਂ ਕਿ ਖੇਤੀਬਾੜੀ ਦੇ ਵਿੱਚ ਚਲਣ ਵਾਲੇ ਕੰਬੈਨ ਵਗੈਰਾ ਦੀ ਵੀ ਆਪਾਂ ਨੂੰ ਵਰਤੋਂ ਬਾਰੇ ਦੱਸਿਆ ਜਾਂਦਾ ਹੈ ਵੀ ਉਹ ਕਿੱਦਾਂ ਚਲਾਈ ਜਾਂਦੀ ਹੈ ਅਤੇ ਕਿੱਦਾਂ ਉਸ ਨੂੰ ਇਸਤੇਮਾਲ ਕੀਤਾ ਜਾਂਦਾ ਨੇ ਜਿੱਦਾਂ ਕਿ ਆਪਾਂ ਦੇਖਦੇ ਹਾਂ ਫੈਸ਼ਨ ਦੇ ਵਿੱਚ ਵੀ ਆਪਾਂ ਫਿਲਮਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਆਪਣੇ ਵਿਰਸੇ ਨੂੰ ਆਪਾਂ ਕਿਵੇਂ ਸੰਭਾਲੀਏ ਅਤੇ ਡਵ ਸਾਬਣ ਦੀ ਆਪਾਂ ਮਸ਼ਹੂਰੀ ਦੇਖਦੇ ਹਾਂ ਕਿ ਇੱਕ ਛੋਟੀ ਬੱਚੀ ਦੇ ਵਿੱਚ ਕਿੰਨੀ ਕਲਾ ਹੈ ਕਿ ਉਹ ਉਸ ਸਾਬਣ ਦੀ ਉਸ ਪ੍ਰੋਡਕਟ ਨੂੰ ਕਿੱਦਾਂ ਆਪਾਂ ਸੇਲ ਕਰਕੇ ਵੇਚਣਾ ਹੈ ਅਤੇ ਕਿਸ ਤਰ੍ਹਾਂ ਆਪਾਂ ਉਸ ਦੀ ਵਰਤੋਂ ਕਰਨੀ ਹੈ ਜਿੱਦਾਂ ਕਿ ਆਪਾਂ ਮਾਘੀ ਮੇਲੇ ਦੇ ਵਿੱਚ ਦੇਖਦੇ ਹਾਂ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਜਿੱਦਾਂ ਲੋਕੀ ਦੂਰੋਂ ਦੂਰੋਂ ਚੱਲ ਕੇ ਘੋੜਿਆਂ ਨੂੰ ਲੈ ਕੇ ਆਉਂਦੇ ਹਾਂ ਅਤੇ ਆਪਾਂ ਘੋੜਿਆਂ ਦਾ ਕਿੱਦਾਂ ਰੱਖ ਰਖਾਵ ਕਰਨਾ ਹੈ ਅਤੇ ਆਪਾਂ ਉਹਨਾਂ ਨਾਲ ਕਿੱਦਾਂ ਰੇਸ ਲਵਾਉਣੀ ਹੈ ਉਹਨਾਂ ਦਾ ਕੀ ਖਾਣਾ ਪੀਣਾ ਹੈ ਆਪਾਂ ਨੂੰ ਉਸ ਬਾਰੇ ਵੀ ਜਾਣਕਾਰੀ ਦਿੰਦੇ ਨੇ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਵਿਸਾਖੀ ਮੇਲਾ ਵੀ ਬੜਾ ਹੀ ਧੂਮ ਧਾਮ ਨਾਲ ਮਣਾਇਆ ਜਾਂਦਾ ਨੇ ਲੋਕੀ ਦੂਰੋਂ ਚਲ ਚਲ ਕੇ ਉੱਥੇ ਮਾਘੀ ਮੇਲੇ ਨੂੰ ਦੇਖਣ ਵਾਸਤੇ ਜਾਂਦੇ ਨੇ ਅਤੇ ਉੱਥੇ ਲੋਕੀ ਆਪਦੀ ਬਾਹਰ ਸਟਾਲਾਂ ਲਾਉਂਦੇ ਨੇ